ਵਿਆਹਾਂ ਵਰਗੇ ਸਮਾਗਮਾਂ 'ਤੇ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਅਤੇ ਜ਼ਰੂਰੀ ਵੀ ਹੁੰਦੀ ਹੈ ਅਸੀਂ ਪਾਣੀ ਦੀ ਵਰਤੋਂ ਬਹੁਤ ਧਿਆਨ ਨਾਲ ਕਰਦੇ ਹਾਂ ਅਤੇ ਉਸ ਤੋਂ ਵੱਧ ਯੂਜ਼ ਨਹੀਂ ਕਰਦੇ ਪਾਣੀ ਬਹੁਤ ਹੀ ਕੀਮਤੀ ਹੈ ਪਾਣੀ ਦੀ ਵਰਤੋਂ ਬਹੁਤ ਧਿਆਨ ਨਾਲ ਕੀਤੀ ਜਾਂਦੀ ਹੈ ਅਤੇ ਜੋ ਜ਼ਰੂਰਤ ਪੈਣ 'ਤੇ ਹੀ ਉਹਨੂੰ ਉਪਯੋਗ ਕੀਤਾ ਜਾਂਦਾ ਹੈ ਪਾਣੀ ਅਸੀਂ ਬਹੁਤ ਇੱਕ ਵੱਡੇ ਟੈਂਕਰ 'ਚ ਸਾਂਭ ਕੇ ਰੱਖ ਰੱਖਦੇ ਹਾਂ ਅਤੇ ਲੋੜ ਪੈਣ ਅਨੁਸਾਰ ਉਸ ਨੂੰ ਯੂਜ ਕਰਦੇ ਹਾਂ ਅਸੀਂ ਪਾਣੀ ਨੂੰ ਬਹੁਤ ਹੀ ਧਿਆਨ ਨਾਲ ਉਪਯੋਗ ਕਰਦੇ ਹਾਂ